ਜਿੱਦਾਂ ਕਿ ਸਾਨੂੰ ਪਤਾ ਹੀ ਆ ਹਾਲ ਹੀ ਦੇ ਵਿੱਚ ਇੱਕ ਘਟਨਾ ਵਾਪਰੀ ਹੈਗੀ ਆ ਅੰਮ੍ਰਿਤਸਰ ਦੇ ਵਿੱਚ ਜਿਹੜਾ ਬੀ ਆਰ ਅੰਬੇਡਕਰ ਦਾ ਜਿਹੜਾ ਪੁਤਲਾ ਹੈਗਾ ਹੈ ਉਹਨੂੰ ਕਿਸੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮੇਰਾ ਓ ਪਰਸਨਲ ਤਜ਼ਰਬਾ ਹੈਗਾ ਹੈ ਕਿ ਜਿਹੜੀ ਸਾਡੇ ਅੱਜ ਕੱਲ੍ਹ ਜਿਹੜੀ ਆਹ ਮੀਡੀਆ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਮੀਡੀਆ ਜਾਂ ਹੋਰ ਸਾਰੀ ਮੀਡੀਆ ਇਹ ਜਿਹੜੀ ਹੈਗੀ ਆ ਸਾਰੀ ਆਪਾਂ ਕਹਿ ਸਕਦੇ ਹਾਂ ਕੀ ਐਮਐਲਏ ਐਮਸੀ ਇਹਦੇ ਥੱਲੇ ਲੱਗੀ ਹੁੰਦੀ ਹੈ ਬਿਕੋਜ਼ ਜ ਜੋ ਕਿ ਕੀ ਕਹਿੰਦੇ ਨੇ ਕਿ ਇਹ ਹਮੇਸ਼ਾ ਉਹਨਾਂ ਦੀ ਹੀ ਗੱਲਾਂ ਸੁਣ ਕੇ ਅਤੇ ਉਹਨਾਂ ਨੂੰ ਕੀ ਕਹਿੰਦੇ ਨੇ ਓ ਉਹਦੀ ਜਿਹੜੀ ਹੈਗੀ ਆ ਹਾਈਪ ਕ੍ਰੀਏਟ ਕਰ ਦਿੰਦੇ ਆ ਜਦ ਕਿ ਅਸਲੀਅਤ ਦੇ ਵਿੱਚ ਇੱਦਾਂ ਕੁਝ ਹੋਇਆ ਨਹੀਂ ਹੁੰਦਾ ਇਹ ਮੇਰੀ ਅੱਖੀ ਦੇਖੀ ਘਟਨਾ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਜਦ ਸਭ ਕੁਛ ਹੋਇਆ ਤਦ ਮੈਂ ਉੱਥੇ ਹੀ ਸੀਗਾ ਛੋਟਾ ਜਿਹਾ ਕਾਂਡ ਹੋਇਆ ਹੈ ਕਿਸੇ ਨੇ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਭੰ ਤੋੜਨ ਦੀ ਕੋਸ਼ਿਸ਼ ਕੀਤੀ ਬਟ ਮੀਡੀਆ ਦੇ ਵਿੱਚ ਉਹ ਚੀਜ਼ ਨੂੰ ਇੰਨਾਂ ਹੱਲਾਸ਼ੇਰੀ ਦੇ ਕੇ ਉਹ ਟੋਪਿਕ ਨੂੰ ਜਿਹੜੇ ਆਪਾਂ ਕਹਿੰਦੇ ਹਾਂ ਇੰਨੀ ਓ ਵਾਇਰਲ ਕਰ ਦਿੱਤਾ ਗਿਆ ਇੰਨਾਂ ਜ਼ਿਆਦਾ ਉਛਾਲਿਆ ਗਿਆ ਕੀ ਜਿਹੜੀ ਬੀ ਆਰ ਅੰਬੇਦਕਰ ਦੇ ਜਿਹੜੇ ਆਪਾਂ ਕਹਿੰਦੇ ਸੀਗੇ ਪਾਰਟੀ ਜਿਹੜੇ ਬੰਦੇ ਸੀਗੇ ਉਹਨਾਂ ਨੇ ਬਹੁਤ ਆਤੰਕ ਮਚਾਇਆ ਸਾਰੀ ਜਗ੍ਹਾ ਬਹੁਤ ਤਬਾਹੀ ਮਚਾਈ ਸੋ ਆਹ ਗੱਲ ਹੈ ਅਤੇ ਜਿਹੜਾ ਸਾਡਾ ਇਹ ਮੀਡੀਆ ਹੈਗਾ ਹੈ ਇਹ ਕਿਤੇ ਨਾ ਕਿਤੇ ਅਹਿੰਸਾ ਫੈਲਾਨ ਦੇ ਹਮੇਸ਼ਾ ਖਿਲਾ ਹਮੇਸ਼ਾ ਅੱਗੇ ਹੁੰਦਾ ਹੈ ਜਦ ਕਿ ਛੋਟੀ ਜਿਹੀ ਚੀਜ਼ ਹੋਈ ਹੁੰਦੀ ਹੈ ਉਹਨੂੰ ਵੱਧ ਚੜ੍ਹ ਕੇ ਮੀਡੀਆ 'ਚ ਦਿਖਾਇਆ ਜਾਂਦਾ ਹੈ